ਵੀਰੇ ਬਰਾੜ ਰੈਸਟੋਰੈਂਟ ਤੋਂ ਬੋਲਦੇ ਹੋ ਮੈਂ ਤੁਹਾਡੇ ਨੇੜੇ ਝੁੰਬੇ ਪਿੰਡ ਤੋਂ ਬਲਜਿੰਦਰ ਬੋਲਦਾ ਸੀ ਹਾਂ ਮੈਨੂੰ ਨਾ ਥੋੜ੍ਹਾ ਜਿਹਾ ਖਾਣਾ ਔਡਰ ਕਰਨਾ ਸੀ ਭੁੱਖ ਲੱਗੀ ਹੈ ਦੋ ਬਰਗਰ ਅਤੇ ਕੋਲਡ ਡਰਿੰਕ ਮੈਂ ਤੁਹਾਡਾ ਪੱਕਾ ਗਾਹਕ ਐ ਤਾਂ ਕਰਕੇ ਮੈਨੂੰ ਲੈੱਸ ਕਰਕੇ ਲਾਓ ਅਤੇ ਥੋੜ੍ਹੇ ਸਮੇਂ ਵਿੱਚ ਭੇਜ ਦਿਓ ਹਾਂਜੀ ਟਾਈਮ ਲੱਗ ਜੁਗਾ ਜ਼ਿਆਦਾ ਸਮਾਂ ਨਹੀਂ ਨਾ ਲੱਗਣਾ ਚਾਹੀਦਾ ਮੇਰੇ ਰਿਸ਼ਤੇਦਾਰ ਆਏ ਬੈਠੇ ਸੀ ਮੇਰਾ ਦੋਸਤ ਆਵੇ ਬੈਠਾ ਸੀ ਆਇਆ ਹੋਇਆ ਸੀ ਹਾਂ ਦੋ ਬਰਗਰ ਪਨੀਰ ਵਾਲੇ ਭੇ ਹਾਂ ਪਨੀਰ ਪਨੀਰ ਵਾਲੇ ਭੇਜ ਦਿਓ ਠੀਕ ਹੈ ਨਹੀਂ ਛੋਟ ਤਾਂ ਕਰਨੀ ਪਊ ਮੈਂ ਤੁਹਾਡਾ ਪੱਕਾ ਗਾਹਕ ਐ ਮੈਂ ਤੁਹਾਡੇ ਤੋਂ ਬਿਨਾਂ ਵਿਜਿਟ ਹੀ ਨਹੀਂ ਕਰਦਾ ਸਮਾਂ ਨਾ ਜ਼ਿਆਦਾ ਲਾਇਓ ਸਮਾਂ ਜ਼ਿਆਦਾ ਦੀ ਤਾਂ ਸਮੱਸਿਆ ਹੈ ਭੁੱਖ ਬਹੁਤ ਲੱਗੀ ਪਈ ਹੈ ਨਾ ਡਲੀਵਰੀ ਤੁਸੀਂ ਕਰ ਦਿਉਂਗੇ ਤਾਂ ਠੀਕ ਹੈ ਨਹੀਂ ਮੈਂ ਆ ਕੇ ਲੈ ਜਾਣਾ ਗਾ ਹਾਂ ਦੇਖ ਲਓ ਤੁਸੀਂ ਇਹ ਮੈਨੂੰ ਦੱਸ ਦਿਓ ਜੇ ਤਾਂ ਤੁਸੀਂ ਪਹੁੰਚਦਾ ਕਰ ਦਿਓਂਗੇ ਤਾਂ ਠੀਕ ਹੈ ਨਹੀਂ ਮੈਂ ਖ਼ੁਦ ਆ ਕੇ ਲੈ ਜਾਵਾਂਗਾ